ਤਿਉਹਾਰ ਤਿਉਹਾਰਾਂ ਦੇ ਟਾਈਮ ਇੰਨੀ ਜ਼ਿਆਦਾ ਐਕਸਾਈਟਿੰਗ ਹੁੰਦੀ ਹੈ ਕਿ ਕੁਝ ਨਵਾਂ ਕਰੀਏ ਜਿਵੇਂ ਜਨਮ ਅਸ਼ਟਮੀ 'ਤੇ ਮੈਂ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਬਣਾਈ ਸੀ ਫਿਰ ਉਹਨਾਂ ਨੂੰ ਵਧੀਆ ਤਰੀਕੇ ਨਾਲ ਕਲਰ ਕੀਤਾ ਡੈਕੋਰੇਟ ਕੀਤਾ ਡੈਕੋਰੇਟ ਕਰਕੇ ਉਹਨਾਂ ਨੂੰ ਆਪਣੇ ਮੰਦਰ ਵਿੱਚ ਸਜਾਇਆ ਹਾਰ ਸ਼ਿੰਗਾਰ ਪੂਰਾ ਕੀਤਾ ਫਿਰ ਉਸ ਤੋਂ ਬਾਅਦ ਮੈਂ ਗਣੇਸ਼ ਗਣੇਸ਼ ਜੀ ਦੀ ਬਹੁਤ ਹੀ ਸੁੰਦਰ ਪਿਆਰੀ ਮੂਰਤੀ ਬਣਾਈ ਇਹਨਾਂ ਨੂੰ ਬਣਾਉਣ ਵਾਸਤੇ ਮੈਂ ਇੰਨੇ ਤਰੀਕੇ ਕੀਤੇ ਕਿ ਕੁਝ ਵੀ ਹੋ ਜੇ ਇਹ ਮੂਰਤੀ ਮੈਂ ਬਣਾਉਣੀ ਹੀ ਬਣਾਉਣੀ ਹੈ ਦੀਵਾਲੀ ਦੇ ਸਮੇਂ ਵੀ ਮੈਨੂੰ ਰੰਗੋਲੀ ਬਣਾਉਣ ਦਾ ਬਹੁਤ ਜ਼ਿਆਦਾ ਸ਼ੌਕ ਹੈ ਜਦੋਂ ਵੀ ਮੈਂ ਇੱਦਾਂ ਦਾ ਕੋਈ ਵੀ ਕੰਮ ਕਰਦੀ ਹਾਂ ਤਾਂ ਮੈਨੂੰ ਇੰਨਾ ਜ਼ਿਆਦਾ ਸਕੂਨ ਮਿਲਦਾ ਹੈ ਕਿ ਮੈਨੂੰ ਬਸ ਇੰਨਾ ਵਧੀਆ ਲੱਗਦਾ ਹੈ ਕਿ ਬਸ ਇਹੀ ਕੰਮ ਕਰੀ ਜਾਵਾਂ ਇਹ ਮੇਰਾ ਪ੍ਰੋਫੈਸ਼ਨ ਵੀ ਬਣ ਗਿਆ ਹੈਗਾ ਇਸ ਲਈ ਮੈਨੂੰ ਕੀ ਕਹਿੰਦੇ ਹੈ ਆਰਟ ਕਰਨਾ ਬਹੁਤ ਪਸੰਦ ਹੈ ਮੈਨੂੰ ਮੂਰਤੀਆਂ ਬਣਾਉਣਾ ਬਹੁਤ ਜ਼ਿਆਦਾ ਪਸੰਦ ਹੈ ਰੰਗੋਲੀਆਂ ਵਗੈਰਾ ਬਹੁਤ ਵਧੀਆ ਲੱਗਦਾ ਹੈ